ਸਾਡੇ ਜ਼ਿਲ੍ਹੇ ਦੀ ਫੁਲਕਾਰੀ ਬਹੁਤ ਹੀ ਵਧੀਆ ਹੈ ਇਹ ਇਤਿਹਾਸ ਤੋਂ ਹੀ ਚੱਲੀ ਆ ਰਹੀ ਹੈ ਇਸ ਨੂੰ ਵਿਆਹੀਆਂ ਕੁੜੀਆਂ ਪਹਿਨਦੀਆਂ ਹਨ ਇਹ ਦੇਖਣ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਇਸ 'ਤੇ ਬਹੁਤ ਸਾਰੀਆਂ ਰੰਗ ਬਰੰਗੀਆਂ ਬੂਟੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਅਲਕੀ ਅਲਕ੍ਰਿਤੀਆਂ ਬਣੀਆਂ ਹੋਈਆਂ ਹਨ ਇਸ ਨੂੰ ਜੋਗ੍ਰਾਫਿਕ ਇੰਡੀਗੇਟਰ ਵੀ ਮਿਲਿਆ ਹੋਇਆ ਹੈ ਇਹ ਬਜ਼ੁਰਗਾਂ ਤੋਂ ਹੀ ਚੱਲੀ ਆ ਰਹੀ ਹੈ ਇਸ ਨੂੰ ਮੋਹਾਲੀ ਅਤੇ ਪੰਜਾਬ ਵਿੱਚ ਬਹੁਤ ਹੀ ਵੱਡਾ ਦਰਜਾ ਦਿੱਤਾ ਗਿਆ ਹੈ